ਮੇਰੀਆਂ ਮਨਪਸੰਦ ਖੇਡਾਂ ਬਹੁਤ ਸਾਰੀਆਂ ਨੇ ਮੈਨੂੰ ਬਚਪਨ ਤੋਂ ਹੀ ਖੇਡਣ ਦਾ ਬਹੁਤ ਚਾਅ ਸੀ ਮੈਂ ਬਚਪਨ ਤੋਂ ਹੀ ਖੇਡਣਾ ਬੜਾ ਪਸੰਦ ਕਰਦੀ ਹਾਂ ਜਿਵੇਂ ਕਿ ਸਟੈਪੂ ਰੱਸਾ ਟੱਪਣਾ ਖੋ ਖੋ ਬਾਂਦਰ ਕਿੱਲਾ ਆਦਿ ਇਸ ਤਰ੍ਹਾਂ ਦੀਆਂ ਕਈ ਤਰ੍ਹਾਂ ਦੀਆਂ ਖੇਡਾਂ ਕਿ ਜਿਹੜਾ ਹੋਕੀ ਵਾਲੀਬਾਲ ਫੁੱਟਬਾਲ ਬੈਟ ਬੋਲ ਇਹ ਚੀਜ਼ ਇਹਦੇ ਵਿੱਚ ਮੈਨੂੰ ਬਹੁਤ ਜ਼ਿਆਦਾ ਜ਼ਿਆਦਾ ਦਿਲਚਸਪੀ ਹੁੰਦੀ ਸੀ ਮੈਨੂੰ ਇਸ ਕਰਕੇ ਪਸੰਦ ਹੈ ਕਿ ਇੱਕ ਤਾਂ ਆਪਣਾ ਸਹੇਲੀਆਂ ਦੇ ਵਿੱਚ ਭਾਈਚਾਰਾ ਬਣਿਆ ਰਹਿੰਦਾ ਹੈ ਫਰੈਂਡਾਂ ਦੇ ਵਿੱਚ ਆਪਸ 'ਚ ਜੁੜੇ ਰਹਿੰਦੇ ਹਾਂ ਬੱਚੇ ਆਪਸ 'ਚ ਜੁੜੇ ਰਹਿੰਦੇ ਨੇ ਪ੍ਰੇਮ ਪਿਆਰ ਦੀ ਭਾਵਨਾ ਬਣੀ ਰਹਿੰਦੀ ਹੈ ਦਿਮਾਗ ਚੁਸਤ ਹੁੰਦਾ ਹੈ ਅਤੇ ਸਰੀਰ ਵੀ ਤੰਦਰੁਸਤ ਰਹਿੰਦਾ ਹੈ ਇਹਨਾਂ ਚੀਜ਼ਾਂ ਨਾਲ ਬਿਮਾਰੀਆਂ ਦੀ ਘੱਟ ਹੁੰ ਹੁੰਦੀ ਹੈ ਕਿ ਬੱਚਾ ਬਿਮਾਰ ਹੋ ਨਹੀਂ ਹੋਏਗਾ ਬਿਮਾਰੀਆਂ ਘੱਟ ਆਉਂਦੀਆਂ ਹਨ ਬਿਮਾਰੀਆਂ ਘੱਟ ਆਉਂਦੀਆਂ ਹਨ ਇਸੇ ਤਰ੍ਹਾਂ ਆਪਣੇ ਬੱਚਿਆਂ ਨੂੰ ਖੇਡਣ ਵੱਲ ਬਹੁਤ ਸਾਰਾ ਧਿਆਨ ਦੇਣਾ ਚਾਹੀਦਾ ਹੈ ਅਤੇ ਅਤੇ ਹੋਰ ਵੀ ਖੇਡਾਂ ਦੇ ਵਿੱਚ ਨਵੀਆਂ ਨਵੇਂ ਤਰ੍ਹਾਂ ਦੀਆਂ ਖੇਡਾਂ ਅੱਜ ਕੱਲ੍ਹ ਜਿਹੜੀਆਂ ਉਹ ਪਹਿਲੀਆਂ ਖੇਡਾਂ ਵਰਗੀਆਂ ਖੇਡਾਂ ਨਹੀਂ ਨੇ ਹੁਣ ਹੋਰ ਤਰ੍ਹਾਂ ਦੀਆਂ ਪਹਿਲੇ ਹੋਰ ਤਰ੍ਹਾਂ ਦੀਆਂ ਹੁੰਦੀਆਂ ਸੀ ਵੇਖਣ ਵਿੱਚ ਵੀ ਇਹ ਚੀਜ਼ਾਂ ਬਹੁਤ ਚੰਗੀਆਂ ਲੱਗਦੀਆਂ ਨੇ ਪੁਰਾਣੀਆਂ ਖੇਡਾਂ ਨੂੰ ਜਦੋਂ ਅਸੀਂ ਕਿਤੇ ਵੇਖਦੇ ਹਾਂ ਮੰਨੋਰੰਜਨ ਦੇ ਟਾਈਮ 'ਤੇ ਪਰ ਵੇਖਣ 'ਚ ਮਜ਼ਾ ਆਉਂਦਾ ਪਰ ਮੈਨੂੰ ਆਪ ਖੇਡਣ ਵੇਖਣ ਨਾਲੋਂ ਆਪ ਖੇਡਣ 'ਚ ਜ਼ਿਆਦਾ ਮਜ਼ਾ ਆਉਂਦਾ ਹੈ ਇਸ ਕਰਕੇ ਮੈਨੂੰ ਖੇਡਾਂ ਵਿੱਚ ਬਹੁਤ ਰੁਚੀ ਹੁੰਦੀ ਹੈ ਅਤੇ ਮੈਂ ਖੇਡਣਾ ਬਹੁਤ ਸਾਰਾ ਪਸੰਦ ਕਰਦੀ ਹਾਂ